ਮੈਨੂੰ ਆਪਦੇ ਜਾਇਦਾਦ ਦੇ ਕਾਗਜ਼ਾਂ ਦੇ ਸੰਭਾਲ ਦੀ ਬੜੀ ਫਿਕਰ ਸੀ ਮੈਨੂੰ ਸੀ ਕਿ ਇਹ ਕਾਗਜ਼ ਕਦੇ ਵੀ ਗੁੰਮ ਨਾ ਹੋਣ ਕਿਉਂਕਿ ਥੋੜ੍ਹੇ ਵਕਤ ਪਹਿਲਾਂ ਸਾਡੇ ਇੱਕ ਮਕਾਨ ਦੀ ਰਜਿਸਟਰੀ ਦੇ ਕਾਗਜ਼ ਗੁੰਮ ਹੋ ਗਏ ਸੀ ਫਿਰ ਮੈਨੂੰ ਮੇਰੀ ਇੱਕ ਸਹੇਲੀ ਸੁਨੀਤਾ ਨੇ ਡਿਜੀਲਾਕਰ ਬਾਰੇ ਦੱਸਿਆ ਮੈਂ ਉਹਦੇ ਕੋਲ ਸਾਰਾ ਸਾਰਾ ਵਿਸਤਾਰ ਨਾਲ ਪੁੱਛਿਆ ਕਿ ਡਿਜੀਲੋਕਰ ਵਿੱਚ ਅਸੀਂ ਆਪਣੇ ਜਾਇਦਾਦ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਕਾਗਜ਼ਾਂ ਦੀ ਕਿਵੇਂ ਸੰਭਾਲ ਕਰ ਸਕਦੇ ਹਾਂ ਉਹਨੇ ਮੈਨੂੰ ਸਾਰੀ ਤਕਨੀਕ ਵਿਸਤਾਰ ਨਾਲ ਸਮਝਾਈ ਕਿ ਡਿਜੀਲੋਕਰ ਵਿੱਚ ਅਸੀਂ ਸਭ ਕੁਛ ਸਕੈਨ ਕਰਕੇ ਸੇਵ ਕਰ ਸਕਦੇ ਹਾਂ ਮਤਲਬ ਸੰਭਾਲ ਕੇ ਰੱਖ ਸਕਦੇ ਹਾਂ ਇਸ ਤਰ੍ਹਾਂ ਮੈਨੂੰ ਇਹ ਪਤਾ ਚੱਲਿਆ ਕਿ ਡਿਜੀਲੋਕਰ ਨਾਲ ਕਾਗਜ਼ਾਂ ਨੂੰ ਕਿਧਰੇ ਵੀ ਚੱਕ ਕੇ ਲਿਜਾਣ ਦੀ ਲੋੜ ਨਹੀਂ ਅਸੀਂ ਕੰਪਿਊਟਰ ਉੱਤੇ ਆਪਦਾ ਪਾਸਵਰਡ ਭਰ ਕੇ ਕਿਸੇ ਵੀ ਜਗ੍ਹਾ 'ਤੇ ਆਪਦੇ ਕਾਗਜ਼ ਪੱਤਰ ਕੱਢ ਸਕਦੇ ਹਾਂ ਅਤੇ ਸਮਝ ਸਕਦੇ ਹਾਂ ਡਿਜੀਲੋਕਰ ਬੜੀ ਚੰਗੀ ਤਕਨੀਕ ਹੈ ਸਾਨੂੰ ਸਭ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ ਸਰਕਾਰ ਨੇ ਸਾਡੇ ਸਭ ਵਾਸਤੇ ਇਹ ਇੱਕ ਚੰਗਾ ਉਪਰਾਲਾ ਕੀਤਾ ਹੈ